ਪੌਦੇ ਉਗਾਉਣ ਲਈ ਮਿੱਟੀ ਦੀ ਕਿਸਮ ਤਿਆਰ ਕਰਨ ਲਈ ਚਾਲ੍ਹੀ ਪ੍ਰਸੈਂਟ ਮਿੱਟੀ ਚਾਲ੍ਹੀ ਪ੍ਰਸੈਂਟ ਅਤੇ ਵੀਹ ਪ੍ਰਸੈਂਟ ਵਿੱਚ ਰੇਤਾ ਮਿਲਾ ਕੇ ਜੋ ਮਿੱਟੀ ਗਾਡਰਿੰਗ ਲਈ ਪੌਦੇ ਤਿਆਰ ਕਰਨ ਲਈ ਵਰਤੀ ਜਾਂਦੀ ਹੈ ਉਹ ਹੀ ਮਿੱਟੀ ਸਭ ਤੋਂ ਉਪਜਾਊ ਮਿੱਟੀ ਦੇ ਤੌਰ 'ਤੇ ਵਰਤੀ ਜਾਂਦੀ ਹੈ